ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਤੁਸੀਂ ਕੌਣ ਬੋਲਦੇ ਪਏ ਹੋ ਅੱਛਾ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਕੇਰਲਾ ਤੋਂ ਆਏ ਹੋ ਹੈਨਾ ਹਾਂਜੀ ਹਾਂ ਠੀਕ ਹੈ ਹਾਂਜੀ ਹਾਂਜੀ ਅਨੀਤਾ ਨੇ ਮੈਨੂੰ ਦੱਸਿਆ ਸੀਗਾ ਕਿ ਉਹਨਾਂ ਦਾ ਕੋਈ ਫਰੈਂਡ ਕੇਰਲਾ ਤੋਂ ਆ ਰਿਹਾ ਤੇ ਉਹਨਾਂ ਨੇ ਪੰਜਾਬ ਘੁੰਮਣਾ ਸੀਗਾ ਬਹੁਤ ਵਧੀਆ ਸਰ ਸਰ ਕਪੂਰਥਲਾ ਦੇ ਵਿੱਚ ਤੇ ਬਹੁਤ ਵਧੀਆ ਚੀਜ਼ ਹੈਗੀ ਆ ਜਿਵੇਂ ਮੈਂ ਗੱਲ ਕਰਾਂ ਤੇ ਸ਼ਾਲੀਮਾਰ ਬਾਗ ਹੈਗਾ ਟਾਈਮ ਸਿਟਿੰਗ ਹੈਗੀ ਆ ਤੇ ਕਾਂਜਲੀ ਵੇਖਣ ਵਾਲਾ ਕਾਂਜਲੀ ਤੇ ਬਹੁਤ ਹੀ ਆਪਣਾ ਜਿਹੜਾ ਕਪੂਰਥਲਾ ਇਤਿਹਾਸਿਕ ਜਗਹਾ ਹੈਗੀ ਆ ਜਿਹੜੀ ਆਪਣੇ ਰਾਜਾ ਮਹਾਰਾਜਾ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਜਿਹੜਾ ਸ਼ਾਲੀਮਾਰ ਬਾਗ ਜਿਵੇਂ ਆਪਾਂ ਸ਼ਾਲੀਮਾਰ ਬਾਗ ਦੀ ਗੱਲ ਕਰਾਂ ਤਾਂ ਤੁਸੀਂ ਸਭ ਤੋਂ ਪਹਿਲਾਂ ਸ਼ਾਲੀਮਾਰ ਬਾਗ ਆ ਕੇ ਦੇਖੋ ਸਰ ਉੱਥੇ ਤੇ ਅੱਜ ਕੱਲ ਤੇ ਹੁਣ ਕਾਰਨੇਵਾ ਲੱਗਾ ਹੋਇਆ ਤੇ ਉਹਦੇ ਵਿੱਚ ਤੇ ਪੰਜਾਬੀ ਦਾ ਤਾਂ ਸਪੈਸ਼ਲ ਜਿਹੜੇ ਟੂਰਿਸਟ ਆ ਰਹੇ ਨਾ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਪੰਜਾਬ ਦਾ ਜਿਹੜਾ ਮਤਲਬ ਖਾਣਾ ਪੀਣਾ ਰਹਿਣ ਸਹਿਣ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਦਿਖਾਇਆ ਹੋਇਆ ਤੁਸੀਂ ਆ ਕੇ ਜਰੂਰ ਦੇਖੋ ਸ਼ਾਲੀਮਾਰ ਬਾਗ ਹਾਂ ਇਹ ਅੰਮ੍ਰਿਤਸਰ ਅੰਮ੍ਰਿਤਸਰ ਰੋਡ ਅੰਮ੍ਰਿਤਸਰ ਰੋਡ ਦੇ ਵਿੱਚ ਤੁਸੀਂ ਆ ਕੇ ਨਾ ਤਾਂ ਉੱਥੇ ਸ਼ਾਲੀਮਾਰ ਬਾਗ ਹੈਗਾ ਤੁਸੀਂ ਕਿਸੇ ਵੀ ਆਪਣੇ ਕਾਰ ਡਰਾਈਵਰ ਨੂੰ ਕਹੋਗੇ ਤਾਂ ਉਹ ਥੋਨੂੰ ਲੈ ਆਉਂਗਾ ਠੀਕ ਆ ਹਾਂ ਸਾਇੰਸ ਸਿਟੀ ਵੀ ਹੈਗਾ ਸਰ ਇੱਥੇ ਬਹੁਤ ਥੋੜਾ ਜਿਹਾ ਜਲੰਧਰ ਰੋਡ ਤੇ ਪੈ ਜਾਂਦਾ ਤੇ ਸਾਇੰਸ ਸਿਟੀ ਵੀ ਬਹੁਤ ਵਧੀਆ ਚੀਜ਼ ਹ ਜਿਹੜੇ ਮਤਲਬ ਦੇਖਣ ਵਾਲੀ ਚੀਜ਼ ਹੈਗੀ ਆ ਤੇ ਇਹ ਉਹਦੇ ਬਾਅਦ ਸ਼ਾਮ ਦੇ ਛੇ ਵਜੇ ਤੋਂ ਬਾਅਦ ਉੱਥੇ ਨਾ ਕੋਂਸੈਟ ਵੀ ਲੱਗਦੇ ਆ ਅੱਜ ਕੱਲ

ਸਰ ਜਿਆਦਾ ਤੇ ਮਤਲਬ ਸਾਇੰਸ ਤੋਂ ਰਿਲੇਟਡ ਹੀ ਹੈਗਾ ਵੈ ਸਰ ਤੇ ਉੱਥੇ ਤੁਸੀਂ ਹਾਂ ਹਾਂ ਤੇ ਤੁਸੀਂ ਆਓ ਤੇ ਵੇਖੋ ਬਹੁਤ ਵਧੀਆ ਚੀਜ਼ ਦੇਖਣ ਵਾਲੀ ਹੈ ਜਿਵੇਂ ਥੋਨੂੰ ਫੋਨ ਤੇ ਦੱਸ ਦਵਾਂਗੇ ਤਾਂ ਤੁਹਾਡੀ ਜਿਹੜੀ ਕਰਿਓਸਿਟੀ ਆ ਉਹ ਖਤਮ ਹੋ ਜੂਗੀ ਨਾ ਤਾਂ ਮੈਂ ਚਾਹੁੰਦੀ ਕਿ ਤੁਸੀਂ ਆਪ ਹੀ ਆ ਕੇ ਟਿਕਟ ਲੈ ਕੇ ਤੁਸੀਂ ਜਰੂਰ ਦੇਖੋ ਸੋ ਰੁਪਏ ਦੀ ਟਿਕਟ ਆ ਸਰ ਸੋ ਰੁਪਏ ਰੁਪਏ ਇੱਕ ਬੰਦੇ ਦੀ ਟਿਕਟ ਹੈਗੀ ਤੁਸੀਂ ਤੁਸੀਂ ਆ ਕੇ ਮਤਲਬ ਨੋ ਨੋ ਕ ਵਜੇ ਨੋ ਵਜੇ ਤੁਸੀਂ ਚੱਲ ਜਾਓ ਨੋ ਵਜੇ ਚਲ ਜਾਓ ਨੋ ਵਜੇ ਓਪਨ ਹੋ ਜਾਂਦਾ ਵਾ ਤੇ ਤੁਸੀਂ ਨੋ ਵਜੇ ਜਦੋਂ ਖੁੱਲ ਜਾਂਦਾ ਤਾਂ ਤੁਸੀਂ ਜਾ ਕੇ ਸੋ ਰੁਪਏ ਦੀ ਟਿਕਟ ਇੱਕ ਬੰਦੇ ਦੀ ਸੋ ਰੁਪਏ ਟਿਕਟ ਹੈਗੀ ਉਹ ਤੁਸੀਂ ਲੈ ਕੇ ਤੁਸੀਂ ਅੰਦਰ ਚਲੇ ਜਾਣਾ ਵਾ ਤੇ ਉਥੇ ਉਹ ਜਲੰਧਰ

ਇੱਕ ਸਰ ਕਾਂਚ ਦੀ ਵੀ ਬਹੁਤ ਵਧੀਆ ਹੈਗਾ ਕਾਂਗਲੀ ਕਾਂਗਲੀ ਦੇ ਵਿੱਚ ਕੀ ਹ ਕੀ ਉਥੇ ਬਹੁਤ ਵਧੀਆ ਪਾਰਕ ਬਣੇ ਨੇ ਤੇ ਜੇ ਤੁਸੀਂ ਫੈਮਲੀ ਦੇ ਨਾਲ ਤੁਸੀਂ ਆ ਰਹੇ ਹੋ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਉਥੇ ਬਹੁਤ ਸੋਹਣਾ ਪਾਰਕ ਬਣਿਆ ਉੱਥੇ ਤੇ ਪਾਣੀ ਦਾ ਵੀ ਵਹਾਓ ਬਹੁਤ ਵਧੀਆ ਤਰੀਕੇ ਨਾਲ ਉੱਥੇ ਜਾਂਦਾ ਤੁਸੀਂ ਹੋਰ ਵਧੀਆ ਚੀਜ਼ਾਂ ਦੇਖਣ ਵਾਲੀ ਹਾਂ ਤੇ ਤੁਸੀਂ

ਹਾਂ ਬਿਲਕੁਲ ਤਾਂ ਤੁਸੀਂ ਆਓ ਤੇ ਤੁਸੀਂ ਆ ਦੇਖੋ ਆ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ